ਮੇਰੇ ਕੋਲ਼ ਕਾਫੀ ਮਨਪਸੰਦ ਅਤੇ ਇਤਿਹਾਸਿਕ ਘਟਨਾਵਾਂ ਵਾਲ਼ੀਆਂ ਕਿਤਾਬਾਂ ਪਈਆਂ ਹਨ ਇਹਨਾਂ ਵਿੱਚੋਂ ਓਪਰੇਸ਼ਨ ਬਲਿਊ ਸਟਾਰ ਜਿਹੜੀ ਕਿ ਕੁਲਦੀਪ ਸਿੰਘ ਬਰਾੜ ਦੀ ਲਿਖੀ ਹੋਈ ਹੈ ਇਸ ਵਿੱਚ ਪੰਜਾਬ ਦੇ ਉੱਨੀ ਸੌ ਚੌਰਾਸੀ ਦੇ ਕਤਲੇਆਮ ਬਾਰੇ ਦ੍ਰਿਸ਼ ਲਿਖਿਆ ਵਾ ਪੇਸ਼ ਕੀਤਾ ਹੈ ਕੁਲਦੀਪ ਸਿੰਘ ਬਰਾੜ ਨੇ ਜਿਹੜੇ ਕਿ ਫੌਜੀ ਅਫਸਰ ਸੀ ਉਹਨਾਂ ਨੇ ਇਸ ਕਿਤਾਬ ਵਿੱਚ ਬੜੇ ਹੀ ਸੁਚੱਜੇ ਢੰਗ ਨਾਲ ਸਿੱਖਾਂ 'ਤੇ ਹੋਏ ਹਮਲੇ ਦ ਦਰਬਾਰ ਸਾਹਿਬ 'ਤੇ ਹੋਏ ਹਮਲੇ ਅਕਾਲ ਤਖਤ ਸਾਹਿਬ ਦੀ ਢਹਾਈ ਬਾਰੇ ਚੰਗੀ ਤਰ੍ਹਾਂ ਦੱਸਿਆ ਹੈ ਇਹ ਵੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਵੀ ਦੱਸਿਆ ਗਿਆ ਹੈ ਇਸ ਕਿਤਾਬ ਵਿੱਚ ਉਜ ਉੱਨੀ ਸੌ ਚੌਰਾਸੀ ਦੇ ਸਮੇਂ ਤੋਂ ਦੋ ਚਾਰ ਗੱਲਾਂ ਪਹਿਲਾਂ ਦੀਆਂ ਲਿਖੀਆਂ ਗਈਆਂ ਹਨ ਅਤੇ ਬਾਅਦ ਦੀਆਂ ਵੀ ਲਿਖੀਆਂ ਗਈਆਂ ਹਨ ਕਿਵੇਂ ਹਾਲਾਤ ਸੀ ਕਿਵੇਂ ਕੀ ਕੁਛ ਵਾਪਰਿਆ ਕਿਵੇਂ ਹਮਲਾ ਹੋਇਆ ਕਿਵੇਂ ਫ਼ੌਜ ਸੱਦੀ ਗਈ ਇਹ ਉ ਇਸ ਕਿਤਾਬ ਨੂੰ ਪੜ੍ਹਨ ਲਈ ਮੈਂ ਦੋ ਤਿੰਨ ਵਾਰ ਇਹ ਕਿਤਾਬ ਪੜ੍ਹੀ ਹੈ ਅਤੇ ਕਿਤਾਬ ਮੈਨੂੰ ਬੜੀ ਵਧੀਆ ਲੱਗੀ ਕੁਲਦੀਪ ਸਿੰਘ ਬਰਾੜ ਦੀ ਇਹਦੇ ਵਿੱਚ ਸੰਤਾਂ ਬਾਰੇ ਜ਼ਰੂਰ ਥੋੜ੍ਹੀਆਂ ਮਾੜੀ ਗੱਲਾਂ ਲਿਖੀਆਂ ਨੇ ਪਰ ਦੇਖਿਆ ਜਾਵੇ ਤਾਂ ਪੜ੍ਹਨ ਵਿੱਚ ਬਹੁਤ ਹੀ ਵਧੀਆ ਲੱਗਦੀ ਹੈ ਜਦੋਂ ਚੌਰਾਸੀ ਵਿੱਚ ਸਿੱਖਾਂ ਦੇ ਗੁਰਦੁਆਰਾ ਹਰਮੰ ਗੁਰੂ ਗੁਰੂ ਘਰ ਵਿਖੇ ਹਮਲਾ ਹੋਇਆ ਅਕਾਲ ਤਖਤ ਸਾਹਿਬ ਦੀ ਢਹਾ ਢੋ ਢਹਾਈ ਕੀਤੀ ਗਈ ਬੰਬਾਂ ਨਾਲ ਟੈਂਕਾਂ ਨਾਲ ਤਾਂ ਸਿੱਖਾਂ ਨੇ ਕਿਵੇਂ ਉਹਨਾਂ ਦਾ ਸਾਹਮਣਾ ਕੀਤਾ ਅਤੇ ਸੰਤਾਂ ਦੀ ਤਾਕਤ ਨੂੰ ਬਿਆਨ ਕਰਿਆ ਇਹ ਇਸ ਕਿਤਾਬ ਇਹ ਕਿਤਾਬ ਮੈਂ ਤੁਹਾਨੂੰ ਵੀ ਕਰਦਾ ਕਿ ਤੁਸੀਂ ਵੀ ਜਰੂਰ ਪੜ੍ਹਿਓ ਇਹ ਕਿਤਾਬ ਪੜ੍ਹਨ ਵਿਹਲੇ ਟਾਈਮ ਹੋਣਾ ਚਾਹੀਦਾ ਹੈ ਅਤੇ ਜੇਕਰ ਹੋ ਸਕਿਆ ਇਹਨੂੰ ਕਿਤਾਬ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਿਓ ਅਤੇ ਕਿਵੇਂ ਅਤੇ ਕਿਵੇਂ ਲੇਖਕ ਕਿਵੇਂ ਬਿਆਨ ਕਰ ਰਿਹਾ ਉਹ ਦ੍ਰਿਸ਼ ਨੂੰ ਤੁਹਾਨੂੰ ਜੇਕਰ ਤੁਸੀਂ ਉਹ ਕਿਤਾਬ ਐਨ ਆਪਣੇ ਮਨ ਤੋਂ ਪੜ੍ਹਦੇ ਹੋ ਤੁਹਾਨੂੰ ਇੰਝ ਲੱਗੂ ਤੁਹਾਡੇ ਅੱਖਾਂ ਸਾਹਮਣੇ ਉਹ ਹੀ ਦ੍ਰਿਸ਼ ਪੇਸ਼ ਹੋਊਂਗਾ ਇਹ ਕਿੱਦਾਂ ਅਤੇ ਕੀ ਵਾਪਰਿਆ ਇੰਝ ਲੱਗਾ ਤੁਸੀਂ ਉੱਥੇ ਉਸੇ ਸਥਾਨ 'ਤੇ ਖੜ੍ਹੇ ਹੋ ਅਤੇ ਤੁਸੀਂ ਉਹ ਦ੍ਰਿਸ਼ ਨੂੰ ਦੇਖ ਰਹੇ ਹੋ ਬਹੁਤ ਵਧੀਆ ਲੱਗਦਾ ਹੈ ਦੇਖ ਪੜ੍ਹ ਕੇ ਕਿਤਾਬ ਨੂੰ ਪੜ੍ਹ ਕੇ ਅਤੇ ਸੰਤਾਂ ਬਾਰੇ ਜਾਣ